ਹਾਂਜੀ ਭਾਅ ਜੀ ਕੀ ਹਾਲ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹੋਰ ਸੁਣਾਓ ਘਰ ਬਾਰ ਠੀਕ ਹੈ ਚਲੋ ਵਧੀਆ ਚਾਹੀਦਾ ਹੋਰ ਝੋਨਾ ਲੱਗ ਗਿਆ ਭਾਅ ਝੋਨੇ ਦਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਹਾਲ ਤਾਂ ਮਾੜਾ ਹੀ ਆ ਭੁੱਖੇ ਮਰਨ ਵਾਲਾ ਹਾਲ ਹੋਇਆ ਪਿਆ ਉੱਤੋਂ ਮੰਗਾਂ ਮੰਗੀਆਂ ਨਹੀਂ ਜਾਣਦੀਆਂ ਚਲੋ ਕੋਈ ਗੱਲ ਨਹੀਂ ਹੋਰ ਕੀ ਬੀਜਣਾ ਫਿਰ ਝੋਨੇ ਤੋਂ ਬਾਅਦ ਓ ਮੈਂ ਸੁਣਿਆ ਸੀ ਐਗਰੀਕਲਚਰ ਡਿਪਾਰਟਮੈਂਟ ਵਾਲੇ ਨਾ ਕਲਾਸਾਂ ਜਿਹੀਆਂ ਲਾ ਰਹੇ ਕਿਸਾਨਾਂ ਦੀਆਂ ਅਤੇ ਉਹਨਾਂ ਨੂੰ ਦੱਸਦੇ ਪਏ ਕਿ ਆਪਾਂ ਬਿਹਤਰ ਕਿਵੇਂ ਫਸਲ ਉਗਾ ਸਕਦੇ ਹਾਂ ਹੈ ਨਾ ਵੱਖ ਵੱਖ ਚੀਜ਼ਾਂ ਖਾ ਸਕਦੇ ਹਾਂ ਬਿਨਾ ਖਾਦਾਂ ਤੋਂ ਅਤੇ ਮੈਂ ਸੋਚਦਾ ਸੀ ਆਪਾਂ ਉੱਥੇ ਨਾ ਚੱਲੀਏ ਇੱਕ ਦਿਨ ਇਹ ਕਲਾਸਾਂ ਲਾ ਆਉਂਦੇ ਹਾਂ ਹਾਂ ਕੋਈ ਗੱਲ ਨਹੀਂ ਦੇਖ ਲਵਾਂਗੇ ਬਾਕੀ ਬਾਕੀ ਦੇਖੋ ਜੇ ਆਪਾਂ ਜੇ ਖਾਦਾਂ ਦੇ ਹਿਸਾਬ ਨਾਲ ਜੇ ਸਬਜ਼ੀਆਂ ਲਾਵਾਂਗੇ ਤਾਂ ਬਚਣਾ ਫਿਰ ਵੀ ਨਹੀਂ ਕੱਖ ਬਿਲਕੁਲ ਜੀ ਹਾਂਜੀ ਹਾਂਜੀ ਉਪਜਾਊ ਸ਼ਕਤੀ ਤਾਂ ਪੂਰੀ ਘਟੀ ਜਾਣ ਦੀ ਆ ਯਾਰ ਕੀ ਕਰ ਸਕਦੇ ਹਾਂ ਕਿੰਨੀ ਖਾਦ ਪਾਈ ਜਾਂਦੇ ਹਾਂ ਓਨੀ ਉਪਜਾਊ ਸ਼ਕਤੀ ਉਹਦੀ ਘਟੀ ਜਾਣਦੀ ਹੈ ਹੁਣ ਹੋਰ ਹੋਰ ਓਨਾ ਹੀ ਹਿਸਾਬ ਲਾ ਕੇ ਚੱਲੋ ਕਿ ਗੋਭੀ ਜਿਹਨੂੰ ਕੋਈ ਪੁੱਛਦਾ ਨਹੀਂ ਸੀ ਉਹ ਅੱਜ ਕੱਲ੍ਹ ਅੱਸੀ ਰੁਪਏ ਕਿਲੋ ਵਿਕ ਰਹੀ ਹੈ ਖਾਦਾਂ ਨਾਲ ਬਣੀ ਹੋਈ ਪਾਲਕ ਇੰਨੀ ਮਹਿੰਗੀ ਵਿਕ ਰਹੀ ਆ ਬਾਥੂ ਸਾਗ ਤੁਹਾਨੂੰ ਪਤਾ ਹੀ ਆ ਹੁਣ ਅੱਗੇ ਆਉਣਾ ਹੀ ਆ ਸਾਰੀ ਕੈਮੀਕਲ ਵਾਲਾ ਸਾਰੀ ਉਹਨਾਂ ਨੇ ਖਾਦਾਂ ਪਾਈਆਂ ਹੋਈਆਂ ਚਲੋ ਕੋਈ ਗੱਲ ਨਹੀਂ ਭਾਅ ਜੀ ਜੇ ਜਾਣਾ ਹੋਇਆ ਨਾ ਫਿਰ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਅਤੇ ਤੁਸੀਂ ਤੁਰ ਪਿਓ ਬਸ ਨਾਲ ਹਾਂ ਤੁਰ ਪਿਓ ਓਕੇ ਚਲੋ ਠੀਕ ਹੈ ਭਾਅ ਜੀ ਓਕੇ ਫੇਰ ਨਹੀਂ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਭਾਅ ਜੀ ਉਹਨਾਂ ਨੂੰ ਤਾਂ ਰੋਕਣਾ ਪੈਣਾ ਹੀ ਆ ਚਲੋ ਠੀਕ ਹੈ ਭਾਅ ਜੀ ਓਕੇ ਓਕੇ ਬਾਏ ਜੀ ਓਕੇ ਓਕੇ ਓਕੇ